ਪਹਿਲਾਂ ਅਤੇ ਹੁਣ ਦੇ ਮੋਬਾਈਲਾਂ ਵਿੱਚ ਬਹੁਤ ਅੰਤਰ ਹੈ ਪਹਿਲਾਂ ਦੇ ਮੋਬਾਈਲ ਸੀ ਜਿਨ੍ਹਾਂ ਦੀ ਮਦਦ ਨਾਲ ਅਸੀ ਨਾ ਖ਼ਾਸ ਕੰਮ ਨਹੀ ਕਰ ਸਕਦੇ ਸੀ ਪਹਿਲਾਂ ਦੇ ਮੋਬਾਇਲ ਫੋਨ ਦੇ ਵਿੱਚ ਸਿਰਫ਼ ਅਸੀਂ ਕਾਲਿੰਗ ਕਰ ਸਕਦੇ ਸੀ ਫੋਟੋ ਵਗੈਰਾ ਖਿੱਚ ਸਕਦੇ ਸੀ ਅਤੇ ਆਪਣੀਆ ਫੋਟੋਸ ਨੂੰ ਦੇਖ ਸਕਦੇ ਸੀ ਪਰ ਹੁਣ ਦੇ ਜੋ ਸਮਾਰਟਫੋਨ ਆ ਚੁੱਕੇ ਹਨ ਇਹਨਾਂ ਦੇ ਵਿੱਚ ਬਹੁਤ ਅੰਤਰ ਹੈ ਇਨ੍ਹਾਂ ਸਮਾਰਟਫੋਨ ਦੇ ਵਿੱਚ ਅਸੀਂ ਫੋਟੋ ਖਿੱਚ ਸਕਦੇ ਹਾਂ ਕਾਲਿੰਗ ਕਰ ਸਕਦੇ ਹਾਂ ਨਕਸ਼ਾ ਤੱਕ ਕੱਢ ਸਕਦੇ ਹਾਂ ਜੇਕਰ ਸਾਨੂੰ ਰਸਤਾ ਨਹੀ ਪਤਾ ਤਾਂ ਅਸੀਂ ਗੂਗਲ ਮੈਕਸ ਦੀ ਮੈਪ ਦੀ ਹੈਲਪ ਨਾਲ ਉਹਦੇ ਉੱਤੇ ਸਰਚ ਕਰਕੇ ਜਿਸ ਏਰੀਏ ਵਿੱਚ ਅਸੀ ਜਾਣਾ ਹੈ ਉਸ ਦੀ ਲੋਕੇਸ਼ਨ ਸਿੰਪਲੀ ਉੱਥੋਂ ਭਰ ਕੇ ਅਸੀ ਉਸ ਰਸਤੇ 'ਤੇ ਆਸਾਨੀ ਨਾਲ ਪਹੁੰਚ ਸਕਦੇ ਹਾਂ ਇਸ ਸਮਾਰਟਫੋਨ ਦੀ ਮਦਦ ਨਾਲ ਅਸੀਂ ਆਨਲਾਈਨ ਪੇਮੈਂਟ ਜਿੱਦਾਂ ਕਿ ਅਸੀਂ ਕਿਸੇ ਨੂੰ ਪੈਸੇ ਦੇਣੇ ਹੋਣ ਅਸੀਂ ਘਰ ਬੈਠੇ ਹੀ ਆਪਣੇ ਮੋਬਾਇਲ ਫੋਨ ਦੀ ਮਦਦ ਨਾਲ ਕਿਸੇ ਨੂੰ ਪੈਸੇ ਵੀ ਸੈਂਡ ਕਰ ਸਕਦੇ ਹਾਂ ਰਹੀ ਗੱਲ ਮੇਰੀ ਮੈਂ ਇਸ ਟਾਈਮ ਏਅਰਟੈੱਲ ਸਿੰਮ ਯੂਜ ਕਰਦਾ ਜਿਹਦੇ ਵਿੱਚ ਮੈਂ ਮੰਥਲੀ ਚਾਰ ਸੌ ਅੱਸੀ ਰੁਪਏ ਵਾਲਾ ਪੈਕ ਪਵਾਉਂਦਾ ਅਤੇ ਜਿਸ ਨਾਲ ਮੇਰੇ ਦੋ ਮੰਥ ਲੰਘਦੇ ਆ ਕਹਿ ਸਕਦੇ ਹਾਂ ਕਿ ਪਹਿਲਾਂ ਜੋ ਪੈਕ ਹੁੰਦੇ ਸਨ ਉਹ ਸਸਤੇ ਹੁੰਦੇ ਸਨ ਪਰ ਇਸ ਟਾਈਮ ਜੋ ਪੈਕ ਨੇ ਬਹੁਤ ਮਹਿੰਗੇ ਹੋ ਗਏ ਹਨ ਜਿਸ ਕਾਰਣ ਗਰੀਬ ਬੰਦੇ ਲਈ ਥੋੜ੍ਹਾ ਪੈਸੇ ਖਰਚ ਕਰਨਾ ਥੋੜ੍ਹਾ ਮੁਸ਼ਕਿਲ ਹੋ ਗਿਆ ਸਮਾਰਟਫੋਨਸ ਦੇ ਵੀ ਸੇਮ ਹੀ ਹੈ ਇਹਨਾਂ ਦੀ ਕੋਸਟ ਵਧ ਬਹੁਤ ਜ਼ਿਆਦਾ ਹੋ ਰਹੀ ਹੈ ਪਰ ਹਾਂ ਸਸਤੇ ਫੋਨ ਮਿਲਦੇ ਤਾਂ ਹਨ ਪਰ ਉਨਕੀ ਕੁਆਲਿਟੀ ਜਿਹੜੀ ਉਹ ਵਧੀਆ ਨਹੀਂ ਹੁੰਦੀ ਡਾਟਾ ਪੈਕਸ ਵੀ ਹੁੰਦੇ ਹਨ ਇਹਨਾਂ ਵਿੱਚ ਇੰਟਰਨੈੱਟ ਦੀ ਫਸੁ ਫੈਸਲਿਟੀ ਉਹ ਬਹੁਤ ਵਧੀਆ ਮਿਲਦੀ ਹੈ ਸਮਾਰਟਫੋਨ ਦੇ ਵਿੱਚ ਜਿਸ ਕਾਰਣ ਅਸੀ ਆਪਣੇ ਸਾਰੇ ਕੰਮ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ